ਸਾਡੇ ਖੇਤਰ ਵਿੱਚ ਕੁਦਰਤੀ ਸਰੋਤ ਵਜੋਂ ਰੇਤ ਬਹੁਤ ਭਰਪੂਰ ਮਾਤਰਾ ਵਿੱਚ ਮਿਲਦੀ ਹੈ ਜਿਸ ਦੀ ਵਪਾਰਕ ਵਰਤੋਂ ਵਜੋਂ ਅਸੀਂ ਰੇਤ ਤੋਂ ਸ਼ੀਸ਼ਾ ਬਣਾ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਰੇਤ ਜਿਸ ਨੂੰ ਸਿਲੀਕੋਨ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਆਦਿ ਤੋਂ ਅਸੀਂ ਸੈਮੀ ਕੰਡਕਟਰ ਚਿਪਸ ਬਣਾ ਸਕਦੇ ਹਾਂ ਪਰ ਹਿੰਦੁਸਤਾਨ ਵਿੱਚ ਸੈਮੀ ਕੰਡਕਟਰ ਚਿਪਸ ਬਣਾਉਣ ਵਾਲੀਆਂ ਕੁਛ ਗਿਣੀਆਂ ਚੁਣੀਆਂ ਹੀ ਫੈਕਟਰੀਆਂ ਉਪਲਬਧ ਹਨ ਜੋ ਕਿ ਬਹੁਤ ਵੱਡੀ ਪੂੰਜੀ ਚਾਹੀਦੀ ਹੈ ਅਤੇ ਇਸ ਫੀਲਡ ਵਿੱਚ ਕੰਮ ਕਰਨ ਲਈ ਉੱਚ ਮਾਹਿਰਾਂ ਦੀ ਵੀ ਲੋੜ ਹੈ ਜੋ ਕਿ ਆਪਣੇ ਦੇਸ਼ ਵਿੱਚ ਉਪਲਬਧ ਨਹੀਂ ਹਨ